ਹੈਲੋ ਹਾਂਜੀ ਸਰ ਨਮਸਤੇ ਸਰ ਸਰ ਮੈਂ ਤੁਹਾਨੂੰ ਕੁਛ ਪੁੱਛਣਾ ਚਾਹੁੰਦਾ ਸੀ ਸਰ ਮੈਂ ਬੂਟ ਲੈਣਾ ਚਾਹੁੰਦਾ ਸਰ ਸਪੋਰਟਸ ਬੂਟਸ ਲੈਣੇ ਨੇ ਸਰ ਸਰ ਮੈਨੂੰ ਨਾ ਬਰੈਂਡਿਡ ਕੰਪਨੀ ਦੇ ਚਾਹੀਦੇ ਨੇ ਸਰ ਜਿਵੇਂ ਐਡੀਡਾਸ ਦੇ ਹੋ ਗਏ ਸਰ ਜਿੱਦਾਂ ਨਾਇਕੀ ਦੇ ਹੋ ਗਏ ਸਰ ਜਿਹਨਾਂ ਦੀ ਨਾ ਸਰ ਕੱਲ੍ਹ ਨੂੰ ਮਤਲਬ ਕਿ ਕੋਈ ਕੰਪਲੇਂਟ ਤੁਸੀਂ ਸਾਨੂੰ ਰਿਟਰਨ ਪੋਲਸੀ ਨਾਲ ਦਿਓ ਜੇ ਸਰ ਮੈਂ ਸਰ ਚਾਹੇ ਸਰ ਕੋਸਟਲੀ ਹੋ ਜਾਣ ਬੂਟ ਸਰ ਕੋਈ ਦਿੱਕਤ ਨਹੀਂ ਸਾਡੇ ਕੋਲ ਕੁਛ ਨਹੀਂ ਮਿਲਦੇ ਮੇਰਾ ਸਰ ਬੂਟ ਵੈਸੇ ਸਰ ਮੈਂ ਆਪਣੇ ਪਹਿਣ ਵਾਸਤੇ ਲੈ ਪਹਿਨਣ ਵਾਸਤੇ ਹੀ ਲੈਣੇ ਨੇ ਸਰ ਹਾਂਜੀ ਸਰ ਤੁਸੀਂ ਸਰ ਥੋੜ੍ਹਾ ਦੱਸੋ ਤਾਂ ਸਹੀ ਸਰ ਕਿਸ ਤਰ੍ਹਾਂ ਦੇ ਬੂਟ ਤੁਹਾਡੇ ਕੋਲ ਪਏ ਨੇ ਸਪੋਰਟਸ ਐਡੀਡਾਸ ਦੇ ਮਤਲਬ ਕਿ ਵਧੀਆ ਪਏ ਨੇ ਕਿ ਉਸ ਤੋਂ ਵਧੀਆ ਕੋਈ ਕੰਪਨੀ ਦੇ ਪਏ ਨੇ ਤਾਂ ਉਹ ਵੀ ਦੱਸ ਦਿਓ ਸਰ ਸਰ ਐਡੀਡਾਸ ਦੇ ਬੂਟ ਸਰ ਲੈਣੇ ਨੇ ਹੁਣ ਤਾਂ ਮਤਲਬ ਕਿੰਨੇ ਕੁ ਰੁਪਏ ਦਾ ਬਣ ਜਾਣਗੇ ਸਰ ਵਧੀਆ ਜੋੜਾ ਲੈਣਾ ਸਰ ਬੂਟਾਂ ਦਾ ਨਹੀਂ ਸਰ ਭਾਵੇਂ ਸਰ ਮੰਨ ਲਓ ਚਾਰ ਹਜ਼ਾਰ ਦੇ ਤੁਸੀਂ ਕਹਿ ਰਹੇ ਹੋ ਸਰ ਕੱਲ੍ਹ ਨੂੰ ਤੁਸੀਂ ਕੋਈ ਗਰੰਟੀ ਦਿਓਗੇ ਸਰ ਬੂਟਾਂ ਦੀ ਨਹੀਂ ਸਰ ਤੁਸੀਂ ਥੋੜ੍ਹਾ ਦੱਸੋ ਤਾਂ ਸਹੀ ਸਰ ਮੰਨ ਲਓ ਕੀ ਕੱਲ੍ਹ ਨੂੰ ਤੁਸੀਂ ਪੱਕਾ ਬਿੱਲ ਨਾਲ ਕੱਟ ਕੇ ਦੇਵੋਗੇ ਸਰ ਉਹ ਸਰ ਜੀ ਐਸ ਟੀ ਦਾ ਤਾਂ ਕੋਈ ਗੱਲ ਨਹੀਂ ਸਰ ਮੈਂ ਅਸੀਂ ਭਰ ਦਾਂਗੇ ਤੁਹਾਡੇ ਕੋਲ ਲੈਣੇ ਸਰ ਤੁਹਾਡਾ ਨਾਮ ਸੁਣਿਆ ਸਰ ਤੁਹਾਡੇ ਬੂਟਾਂ ਦੀ ਦੁਕਾਨ ਮਸ਼ਹੂਰ ਹੈਗੀ ਸਰ ਸਾਡੇ ਇਲਾਕੇ 'ਚ ਹੁਣ ਤੁਸੀ ਸਾਨੂੰ ਦੱਸੋ ਤੁਸੀਂ ਮਤਲਬ ਕਿ ਸਰ ਜੀ ਐੱਸ ਟੀ ਕਿੰਨੇ ਪ੍ਰਸੈਂਟ ਲਾਓਂਗੇ ਸਰ ਬੂਟਾਂ 'ਤੇ ਕੁਲ ਮਿਲਾ ਕੇ ਸਰ ਪੰਤਾਲੀ ਸੰਤਾਲੀ ਸੌ ਤੱਕ ਵਧੀਆ ਤੁਸੀਂ ਸਰ ਮਤਲਬ ਕਿ ਆਪਣਾ ਕਮੀਸ਼ਨ ਵਿੱਚ ਰੱਖ ਲਉਂਗੇ ਸਰ ਕੋਈ ਲੈਸ ਵਗੈਰਾ ਦਿਉਂਗੇ ਸਰ ਨਹੀਂ ਸਰ ਕੁਛ ਤਾਂ ਮੇਰੀ ਗੱਲ ਸੁਣੋ ਸਰ ਕੁਛ ਤਾਂ ਮਾਰਜਨ ਘੱਟ ਕਰੋਂਗੇ ਸਰ ਅਸੀਂ ਤੁਹਾਡੇ ਕੋਲ ਦੋ ਜੋੜੇ ਪਰਚੇਸ ਕਰਾਂਗੇ ਸਰ ਨਹੀਂ ਸਰ ਭਾਵੇਂ ਇੱਕ ਤਾਂ ਸਰ ਤੁਸੀਂ ਥੋੜ੍ਹਾ ਦੱਸੋਗੇ ਸਰ ਇਹਨਾਂ ਨੂੰ ਆਪਾਂ ਸਾਫ਼ ਵਗੈਰਾ ਕਿਵੇਂ ਕਰ ਸਕਦੇ ਹਾਂ ਸਰ ਨਹੀਂ ਸਰ ਅਸੀਂ ਮੈਂ ਪੁੱਛ ਰਿਹਾ ਜੇ ਮੰਨ ਲਓ ਮੈਂ ਬੂਟਾਂ ਨੂੰ ਸਾਫ਼ ਕਿਵੇਂ ਕਰ ਸਕਦੇ ਹਾਂ ਅਸੀਂ ਮਤਲਬ ਕਿ ਅਸੀਂ ਜਿਵੇਂ ਘਰ ਆਪਾਂ ਜਾਂਦੇ ਹਾਂ ਬੂਟ ਗੰਦੇ ਹੋ ਜਾਂਦੇ ਨੇ ਸਰ ਇੱਕ ਵਾਰੀ ਅਸੀਂ ਵੋਸ਼ ਕੀਤੇ ਸੀ ਸਰ ਧੋਣ ਤੋਂ ਬਾਅਦ ਨਾ ਉਹ ਸਰ ਸਾਰੇ ਹੀ ਗੰਦੇ ਹੋ ਗਏ ਸੀ ਸਰ ਥੋੜ੍ਹਾ ਦੱਸੋਗੇ ਸਰ ਹਾਂਜੀ ਨਹੀਂ ਸਰ ਅੱਗੇ ਵੀ ਇੱਕ ਵਾਰੀ ਤੁਹਾਡੇ ਕੋਲ ਲਿੱਤਾ ਸੀ ਸਰ ਹੁਣ ਤੁਸੀਂ ਪੱਕਾ ਗਰੰਟੀ ਦਿਓਗੇ ਨਾ ਸਰ ਅੱਗੇ ਪਿਛਲੀ ਵਾਰੀ ਤੁਸੀਂ ਕਿਹਾ ਸੀ ਉਦੋਂ ਤੁਸੀਂ ਰਿਟਨ ਕੀਤੇ ਨਹੀਂ ਸੀ ਹੁਣ ਕਰ ਲਓਂਗੇ ਨਾ ਸਰ ਇਹਨਾਂ ਇਹਨਾਂ ਦੇ ਕੰਪਨੀ ਦੇ ਬੂਟਾਂ 'ਚੋਂ ਸਮੈਲ ਵਗੈਰਾ ਤਾਂ ਨਹੀਂ ਆਏਗੀ ਸਰ ਕਈ ਨਹੀਂ ਸਰ ਕਈ ਵਾਰੀ ਨਾ ਆਪਾਂ ਜੁਰਾਬਾਂ ਵਗੈਰਾ ਸੋਕਸ ਅ ਜੁਰਾਬਾਂ ਨਹੀਂ ਪਾਉਂਦੇ ਤਾਂ ਉਹਨਾਂ ਨਾਲ ਕਈ ਵਾਰ ਬੂਟਾਂ ਸਮੈਲ ਆਉਣ ਲੱਗ ਜਾਂਦੀ ਹੈ ਮੈਂ ਸੁਣਿਆ ਸੀ ਕੰਪਨੀ ਨੇ ਬੋਲੋ ਸਮੈਲ ਨਹੀਂ ਆਉਂਦੀ ਕੀ ਸਹੀ ਹੈ ਸਰ ਸਰ ਮੰਨ ਲਓ ਇਹਨਾਂ 'ਚ ਆਪਾਂ ਜਦੋਂ ਆਪਾਂ ਇਹਨੂੰ ਜਦੋਂ ਡੱਬੇ 'ਚ ਬੰਦ ਕਰਕੇ ਰੱਖਣੀ ਆ ਸਰ ਤਾਂ ਉਦੋਂ ਆਪਾਂ ਨੂੰ ਅਖ਼ਬਾਰ ਵਿੱਚ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ ਸਰ ਨਹੀਂ ਸਰ ਫਿਰ ਮਤਲਬ ਕਿ ਇੱਕ ਤਾਂ ਇਹਨਾਂ ਅ ਠੀਕ ਰਹਿਣਗੇ ਸਰ ਖ਼ਰਾਬ ਤਾਂ ਨਹੀਂ ਹੋਣਗੇ ਸਰ ਵਿੱਚੋਂ ਦੀ ਸਰ ਕੋਈ ਨਹੀਂ ਮੈਂ ਫਿਰ ਕੱਲ੍ਹ ਆਵਾਂਗਾ ਸਰ ਪੱਕਾ ਬਿੱਲ ਕੱਟ ਕੇ ਦੇ ਜਿਆ ਸਰ ਠੀਕ ਹੈ ਸਰ ਧੰਨਵਾਦ ਸਰ